ਸਤਿ ਸ਼੍ਰੀ ਅਕਾਲ ਜੀ ਤੁਸੀਂ ਸਵੀਗੀ ਅ ਤੋਂ ਗੱਲ ਕਰ ਰਹੇ ਹੋ ਮੈਂ ਹਾਂਜੀ ਅ ਮੈਂ ਹਾਂ ਮੇਰੀ ਸ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਹਾਲ ਦੇ ਵਿੱਚ ਮੈਂ ਇੱਥੋਂ ਤੁਹਾਡੇ ਦੁਕਾਨ ਤੋਂ ਔਡਰ ਕਰਦਾ ਸੀ ਤਾਂ ਉਸ ਦੇ ਵਿੱਚ ਮੈਂ ਆਪਣਾ ਸਵੈ ਭੁਗਤਾਨ ਦੀ ਜਿਹੜੀ ਸੈਟਿੰਗ ਹੈ ਉਹ ਆਨ ਕਰੀ ਹੋਈ ਸੀ ਜੀ ਤਾਂ ਜਿਹਦੇ ਕਰਕੇ ਮੈਂ ਹਮੇਸ਼ਾ ਆਨ ਰੱਖਦਾ ਸੀ ਕਿ ਆਸਾਨ ਹੋ ਜਾਂਦਾ ਔਡਰ ਕਰਨਾ ਪਰ ਇਹ ਇਸ ਕਾਰਨ ਮੈਨੂੰ ਹੁਣ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਵੀ ਝ ਝੇਲਣੀਆਂ ਪੈ ਰਹੀਆਂ ਨੇ